ਹੈਲੋ ਸਤਿ ਸ਼੍ਰੀ ਅਕਾਲ ਜੀ ਮੈਮ ਮੈਂ ਨਾ ਪੰਜਾਬ ਤੋਂ ਬਾਹਰ ਤੋਂ ਆ ਰਿਹਾ ਪੰਜਾਬ 'ਚ ਤਾਂ ਮੈਨੂੰ ਤੁਸੀਂ ਕੋਈ ਵਧੀਆ ਪਲੇਸਿਜ਼ ਘੁੰਮਣ ਵਾਸਤੇ ਦੱਸ ਸਕਦੇ ਓ ਕਿਹੜੀਆਂ ਕਿਹੜੀਆਂ ਨੇ ਠੀਕ ਹੈ ਜੀ ਠੀਕ ਹੈ ਜੀ ਧਾਰਮਿਕ ਸਥਾਨ ਬਾਰੇ ਦੱਸਦੋ ਜੇ ਧਾਰਮਿਕ ਸਥਾਨ ਹੋਰ ਕੀਤੇ ਕੋਈ ਹੈਗਾ ਅੰਮ੍ਰਿਤਸਰ ਸਾਹਿਬ ਤੋਂ ਠੀਕ ਹੈ ਜੀ ਠੀਕ ਹੈ ਜੀ ਇੱਕ ਮੈਂ ਅਨੰਦਪੁਰ ਸਾਹਿਬ ਦਾ ਨਾਮ ਸੁਣਿਆ ਸੀ ਤਾਂ ਥੋੜ੍ਹਾ ਜਿਹਾ ਤੁਸੀਂ ਦੱਸ ਸਕਦੇ ਓ ਵੀ ਅਨੰਦਪੁਰ ਸਾਹਿਬ ਸਾਨੂੰ ਚੰਡੀਗੜ੍ਹ ਤੋਂ ਕਿੰਨਾ ਕੁ ਪੈ ਸਕਦਾ ਜਾਂ ਉੱਥੇ ਕੀ ਕੀ ਚੀਜ਼ਾਂ ਹੈਗੀਆ ਨੇ ਦੇਖਣਯੋਗ ਠੀਕ ਠੀਕ ਹੈ ਠੀਕ ਹੈ ਥੈਂਕ ਯੂ ਸੋ ਮੱਚ ਮੈਮ ਮੈਂ ਨਾ ਫਿਰ ਤੁਹਾਨੂੰ ਆਫ਼ਿਸ ਆ ਕੇ ਮਿਲਦਾ ਜੀ ਓਕ ਠੀਕ ਹੈ ਜੀ ਓਕੇ ਮੈਮ